ਇੱਕ ਸੌ ਪੰਜਾਹ ਇੱਕ ਹਜ਼ਾਰ ਦੋ ਸੌ ਚਾਲ੍ਹੀ ਦੋ ਹਜ਼ਾਰ ਚਾਰ ਸੌ ਸੱਠ ਸੱਤਰ ਹਜ਼ਾਰ ਪੰਜ ਸੌ ਦਸ ਅੱਠ ਲੱਖ ਨੌ ਹਜ਼ਾਰ ਸੱਤ ਸੌ ਚਾਲ੍ਹੀ